ਅੰਗਰੇਜ਼ਾਂ ਨੇ ਪੰਜਾਬ ਵਿੱਚ ਰੇਲਵੇ ਦਾ ਨਿਰਮਾਣ ਆਪਣੇ ਲਾਭ ਲਈ ਕਰਵਾਇਆ ਕਿਉਂਕਿ ਉਸ ਸਮੇਂ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਪੰਜਾਬ ਵਿੱਚ ਬਹੁਤ ਸਾਰੇ ਬੀਜ ਉਗਾਏ ਜਾਂਦੇ ਸਨ ਜੋ ਕਿ ਕੱਚੇ ਮਾਲ ਦੇ ਤੌਰ 'ਤੇ ਅੰਗਰੇਜ਼ ਬਾਹਰ ਲੈ ਕੇ ਜਾਂਦੇ ਸਨ ਅਤੇ ਉਹਨਾਂ ਨੂੰ ਪਕਾ ਕੇ ਦੂਹਰੇ ਰੇਟਾਂ 'ਤੇ ਆ ਕੇ ਵੇਚਦੇ ਸਨ ਪਰ ਉਹਨਾਂ ਦਾ ਵਪਾਰਿਕ ਕੇਂਦਰ ਜ਼ਿਆਦਾਤਰ ਵੱਡੇ ਵੱਡੇ ਸ਼ਹਿਰਾਂ ਦਾ ਵੱਡੇ ਵੱਡੇ ਸ਼ਹਿਰਾਂ ਵਿੱਚ ਹੀ ਸੀ ਇਸ ਲਈ ਉਹਨਾਂ ਨੇ ਪੰਜਾਬ ਵਿੱਚ ਰੇਲ ਦਾ ਨਿਰਮਾਣ ਕਰਵਾਇਆ ਅਤੇ ਵੱਖ ਵੱਖ ਸੂਬਿਆਂ ਵੱਖ ਵੱਖ ਛੋਟੇ ਸੂਬਿਆਂ ਵਿੱਚ ਵੀ ਆਪਣਾ ਭੜਕ ਆਪਣੀ ਪ੍ਰੋਡਕਸ਼ਨ ਪ੍ਰੋਡਕਸ਼ਨ ਨੂੰ ਜਾਰੀ ਕੀਤਾ ਉਹਨਾਂ ਨੇ ਉਹਨਾਂ ਨੇ ਆਜ਼ਾਦ ਨਿਰਜਾਤ ਨੂੰ ਸੌਖਾ ਕਰਨ ਲਈ ਹੀ ਰੇਲਵੇ ਦਾ ਨਿਰਮਾਣ ਕਰਵਾਇਆ ਤਾਂ ਕਿ ਕੱਚੇ ਮਾਲ ਦੇ ਤੌਰ 'ਤੇ ਵਸਤੂਆਂ ਨੂੰ ਬਾਹਰ ਲਿਜਾਇਆ ਜਾਵੇ ਬਾਹਰ ਲਿਜਾਇਆ ਜਾਵੇ ਅਤੇ ਉਹਨਾਂ ਨੂੰ ਪਕਾ ਕੇ ਆ ਉਹਨਾਂ ਨੂੰ ਪਕਾ ਕੇ ਦੂ ਦੂਸਰੇ ਵੱਧ ਰੇਟਾਂ 'ਤੇ ਪੰਜਾਬ ਵਿੱਚ ਵੇਚਿਆ ਜਾ ਸਕੇ ਉਹਨਾਂ ਨੇ ਪੰਜਾਬ ਨੂੰ ਆਪਣਾ ਵਪਾਰਿਕ ਕੇਂਦਰ ਬਣਾਇਆ ਕਿਉਂਕਿ ਪੰਜਾਬ ਇੱਕ ਬਹੁਤ ਹੀ ਵਿਕਸਿਤ ਸੂਬਾ ਮੰਨਿਆ ਜਾਂਦਾ ਸੀ ਉਸ ਸਮੇਂ ਇਸ ਦੇ ਨਾਲ ਹੀ ਹੌਲੀ ਹੌਲੀ ਰੇਲਵੇ ਦਾ ਵਿਕਾਸ ਹੋਇਆ ਅਤੇ ਓਹ ਅਤੇ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਇਸ ਦੀ ਗਤੀਸ਼ੀਲਤਾ ਵਿੱਚ ਹੋਰ ਵੀ ਵਾਧਾ ਆਇਆ ਜ਼ਿਆਦਾ ਤੋਂ ਜ਼ਿਆਦਾ ਰੇਲਵੇ ਜੰਕਸ਼ਨ ਸਥਾਪਿਤ ਕੀਤੇ ਗਏ ਜਿਸ ਨਾਲ ਲੋਕਾਂ ਨੂੰ ਆਉਣ ਜਾਣ ਵਿੱਚ ਵੀ ਬਹੁਤ ਸੁਵਿਧਾ ਮਿਲਣ ਲੱਗੀ ਆਉਣ ਜਾਣ ਵਿੱਚ ਬਹੁਤ ਸੁਵਿਧਾ ਮਿਲਣ ਲੱਗੀ ਇਸ ਨਾਲ ਸ਼ਹਿਰੀਕਰਨ ਸ਼ਹਿਰੀਕਰਨ ਵੀ ਸਥਾਪਿਤ ਹੋਇਆ ਸ਼ਹਿਰ ਨੂੰ ਪਿੰਡਾਂ ਦੇ ਲੋਕ ਸ਼ਹਿਰਾਂ ਵਿੱਚ ਜਾ ਕੇ ਕੰਮ ਕਰਨ ਲੱਗੇ ਉਨ ਉਹ ਵੱਖ ਵੱਖ ਫੈਕਟਰੀਆਂ ਕੰਪਨੀਆਂ ਵਿੱਚ ਕੰਮ ਕਰਨ ਲੱਗੇ ਆਉਣਾ ਜਾਣਾ ਉਹਨਾਂ ਲਈ ਸੌਖਾ ਹੋ ਗਿਆ ਕਿਉਂਕਿ ਰੇਲਵੇ ਇੱਕ ਬਹੁਤ ਹੀ ਸਸਤਾ ਸਾਧਨ ਹੈ ਆਵਾਜਾਈ ਦਾ ਬਹੁਤ ਹੀ ਸਸਤਾ ਸਾਧਨ ਹੈ ਸਸਤਾ ਅਤੇ ਸੁਵਿਧਾ ਦਾ ਇੱਕ ਸਾਧਨ ਮੰਨਿਆ ਜਾਂਦਾ ਹੈ ਉਹਨਾਂ ਨੇ ਰੇਲ ਰੇਲਵੇ ਨੂੰ ਹੁਣ ਬਹੁਤ ਹੀ ਵਿਕਸਿਤ ਕੀਤਾ ਜਾ ਰਿਹਾ ਹੈ ਇਸ ਨਾਲ ਲੋਕਾਂ ਨੂੰ ਆਉਣਾ ਜਾਣਾ ਵਪਾਰ ਕਰਨਾ ਬਹੁਤ ਹੀ ਸੌਖਾ ਹੋ ਗਿਆ ਹੈ ਰੇਲਵੇ ਟਿਕਟ ਹਰੇਕ ਲਈ ਹਰੇਕ ਲਈ ਜਾਇਜ਼ ਹੈ ਵੱਡੇ ਤੋਂ ਲੈ ਕੇ ਛੋਟੇ ਤੱਕ ਸਾਰੇ ਲੋਕ ਇਸ ਨੂੰ ਅਫੋਡ ਕਰ ਸਕਦੇ ਹਨ